ਮੈਨੂੰ ਬਾਈਕਿੰਗ ਦਾ ਬਹੁਤ ਸ਼ੌਂਕ ਹੈ ਮੈਂ ਜਿੱਥੇ ਵੀ ਜਾਣਾ ਹੋਵੇ ਆਮ ਤੌਰ 'ਤੇ ਮੈਂ ਬਾਈਕਿੰਗ ਨੂੰ ਹੀ ਤਰਜੀਹ ਦਿੰਦਾ ਹਾਂ ਬਾਈਕਿੰਗ ਨਾਲ ਤਾਜ਼ੀ ਹਵਾ ਲੱਗਦੀ ਰਹਿੰਦੀ ਹੈ ਅਤੇ ਗਰਮੀਆਂ ਵਿੱਚ ਏ ਸੀ ਦੀ ਲੋੜ ਵੀ ਨਹੀਂ ਪੈਂਦੀ ਮੈਂ ਹਰ ਵੇਲੇ ਆਪਣੇ ਨਾਲ ਇੱਕ ਫਰਸਟ ਏਡ ਬੋਕਸ ਰੱਖਦਾ ਹਾਂ ਜਿਸ ਵਿੱਚ ਜ਼ਰੂਰਤ ਦੀ ਕਈ ਦਵਾਈਆਂ ਜਿਵੇਂ ਕਿ ਬੁਖਾਰ ਦੀ ਦਵਾਈ ਦਰਦ ਦੀ ਦਵਾਈ ਉਲਟੀਆਂ ਆਦਿ ਦੀ ਦਵਾਈ ਹੁੰਦੀਆਂ ਹਨ ਨਾਲ ਹੀ ਮੈਂ ਇੱਕ ਪਾਣੀ ਦੀ ਬੋਤਲ ਵੀ ਜ਼ਰੂਰ ਹਰ ਵੇਲੇ ਆਪਣੇ ਨਾਲ ਰੱਖਦਾ ਹਾਂ ਜੋ ਕਿ ਕਿਤੇ ਵੀ ਲੋੜ ਪੈਣ 'ਤੇ ਮੈਂ ਇਹਨਾਂ ਦੀ ਵਰਤੋਂ ਕਰਕੇ ਖੁਦ ਨੂੰ ਸਿਹਤਮੰਦ ਰੱਖ ਸਕਾਂ ਮੇਰੇ ਫਰਸਟ ਏਡ ਬੋਕਸ ਵਿੱਚ ਹਰ ਵੇਲੇ ਜਖ਼ਮ 'ਤੇ ਲਾਉਣ ਵਾਲੇ ਮੱਲਮ ਅਤੇ ਕੁਝ ਪੱਟੀਆਂ ਵੀ ਮੌਜੂਦ ਹੁੰਦੀਆਂ ਹਨ ਜਿਸ ਨਾਲ ਅਗਰ ਕਦੇ ਵੀ ਕੋਈ ਦੁਰਘਟਨਾ ਵੀ ਹੋ ਜਾਵੇ ਤਾਂ ਵੀ ਮੈਂ ਇਨ੍ਹਾਂ ਦੀ ਵਰਤੋਂ ਕਰਕੇ ਖੁਦ ਨੂੰ ਸਿਹਤਮੰਦ ਰੱਖ ਸਕਦਾ ਹਾਂ ਮੈਂ ਸੜਕਾਂ 'ਤੇ ਆਮ ਤੌਰ 'ਤੇ ਢਾਬਿਆਂ 'ਤੇ ਰੁਕ ਕੇ ਹੀ ਭੋਜਨ ਕਰਨਾ ਪਸੰਦ ਕਰਦਾ ਹਾਂ ਕਦੇ ਕਦੇ ਸ਼ਹਿਰ ਵਿੱਚ ਘੁੰਮਦੇ ਹੋਏ ਮੈਂ ਕਿਸੇ ਰੇੜੀ 'ਤੇ ਕੁਲਚਾ ਮੋਮੋਸ ਆਦਿ ਵੀ ਖਾ ਲੈਂਦਾ ਹਾਂ ਪਰ ਜ਼ਿਆਦਾਤਰ ਲੰਬੇ ਸਫ਼ਰ 'ਤੇ ਮੈਂ ਢਾਬਿਆਂ 'ਤੇ ਹੀ ਸਾਦੀ ਦਾਲ ਰੋਟੀ ਖਾਣ ਨੂੰ ਤਰਜੀਹ ਦਿੰਦਾ ਹਾਂ ਬਾਈਕਿੰਗ ਯਾਤਰਾ ਵੇਲੇ ਕਦੇ ਕਦੇ ਮੈਨੂੰ ਪਿੱਠ ਦਰਦ ਦਾ ਅਨੁਭਵ ਹੁੰਦਾ ਹੈ ਜਦੋਂ ਰਸਤੇ ਬਹੁਤ ਹੀ ਜ਼ਿਆਦਾ ਖ਼ਰਾਬ ਹੋਣ ਜਾਂ ਕਿਸੇ ਬਹੁਤ ਹੀ ਲੰਬੇ ਸਫ਼ਰ 'ਤੇ ਜਾਣਾ ਹੋਵੇ ਤਾਂ ਮੈਨੂੰ ਪਿੱਠ ਦਰਦ ਦਾ ਅਨੁਭਵ ਹੁੰਦਾ ਹੈ ਪਰ ਜਦੋਂ ਮੈਂ ਦੋ ਤਿੰਨ ਘੰਟੇ ਲੱਕ ਸਿੱਧਾ ਕਰਕੇ ਪੈ ਜਾਂਦਾ ਹਾਂ ਅਤੇ ਆਰਾਮ ਕਰਦਾ ਹਾਂ ਤਾਂ ਇਹ ਦਰਦ ਬਿਨਾਂ ਕਿਸੇ ਦਵਾ ਦਾਰੂ ਦੀ ਵਰਤੋਂ ਤੋਂ ਹੀ ਠੀਕ ਹੋ ਜਾਂਦਾ ਹੈ ਕੁਝ ਲੋਕਾਂ ਨੂੰ ਤਾਂ ਮੋਢੇ ਦਰਦ ਦੀ ਸਮੱਸਿਆ ਵੀ ਹੁੰਦੀ ਹੈ ਪਰ ਅਜੇ ਤੱਕ ਮੋਢੇ ਦਰਦ ਦੀ ਸਮੱਸਿਆ ਦਾ ਅਨੁਭਵ ਬਾਈਕਿੰਗ ਕਰਦੇ ਹੋਏ ਮੈਂ ਕਦੇ ਨਹੀਂ ਕੀਤਾ